ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮੈਮ ਹਾਂਜੀ ਮੈਮ ਅਸੀਂ ਹਰਿਮੰਦਰ ਸਾਹਿਬ ਘੁੰਮ ਆਏ ਹਾਂ ਅਤੇ ਹੁਣ ਅੱਗੇ ਆਪਾਂ ਕਿੱਥੇ ਵੀਜ਼ਿਟ ਕਰੀਏ ਘੁੰਮਣ ਜਾਈਏ ਅੱਛਾ ਜੀ ਠੀਕ ਹੈ ਜੀ ਅਤੇ ਉਹਦੀ ਆਹ ਟਾਈਮਿੰਗ ਕੀ ਹੈ ਅਤੇ ਐਂਟਰੀ ਫੀਸ ਕਿੰਨੀ ਹੈਗੀ ਆ ਠੀਕ ਹੈ ਜੀ ਹਾਂ ਫ਼ਿਰ ਆਪਾਂ ਸ਼ਾਮੀ ਚਾਰ ਵਜੇ ਚੱਲ ਸਕਦੇ ਹਾਂ ਓਕੇ